ਖੇਡਾਂ ਖੇਡਣ ਦੇ ਬਹੁਤ ਹੀ ਫਾਇਦੇ ਹਨ ਮੈਨੂੰ ਵੀ ਖੇਡਣ ਦਾ ਬਹੁਤ ਸ਼ੌਕ ਸਾ ਸੌਕ ਹੈ ਸਾਡੇ ਪਿੰਡ ਵਿੱਚ ਖੇਡ ਦਾ ਕਾਫੀ ਵੱਡਾ ਮੈਦਾਨ ਹੈ ਉੱਥੇ ਸਾਡੇ ਲਾਗ ਲਾਗ ਦੇ ਪਿੰਡਾਂ ਦੇ ਲੋਕ ਮੁੰਡੇ ਅਤੇ ਕੁੜੀਆਂ ਖੇਡਣ ਲਈ ਇੱਥੇ ਆਉਂਦੇ ਹਨ ਉਹ ਸਭ ਆਪਸ ਵਿੱਚ ਮਿਲ ਜੁਲ ਕੇ ਇਕੱਠੇ ਖੇਡਦੇ ਹਨ ਇੱਕ ਦੂਜੇ ਦੀ ਪੂਰੀ ਰਿਸਪੈਕਟ ਕਰਦੇ ਹਨ ਖੇਡਾਂ ਖੇਡਣ ਨਾਲ ਸਭ ਤੰਦਰੁਸਤੀ ਅਤੇ ਫਿਟ ਰਹਿੰਦੇ ਹਨ ਖੇਡਾਂ ਸਾਡੇ ਧਿਆਨ ਹੋਣ ਨਾਲ ਲੋਕਾਂ ਦਾ ਨਸ਼ਿਆਂ ਵੱਲ ਧਿਆਨ ਨਹੀਂ ਜਾਂਦਾ ਉਹ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ ਅਤੇ ਇੱਕ ਟੀਮ ਬਣਾ ਕੇ ਖੇਡਾਂ ਖੇਡਦੇ ਹਨ ਅਤੇ ਇੱਕ ਦੂਜੇ ਦੀ ਪੂਰੀ ਮਦਦ ਕਰਦੇ ਹਨ